ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜੀ ਇਹ ਗੱਲ ਕਰਾਂ ਕਿ ਰਵਾਇਤੀ ਪੰਜਾਬੀ ਗਹਿਣਿਆਂ ਦੀ ਕੁਝ ਆਮ ਕਿਸਮਾਂ ਹਨ ਅਤੇ ਇਹ ਗਹਿਣੇ ਕਿਸ ਮੌਕੇ 'ਤੇ ਪਾਏ ਜਾਂਦੇ ਹਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂਗੀ ਕਿ ਰਵਾਇਤੀ ਪੰਜਾਬੀ ਗਹਿਣਿਆਂ ਸਾਡੇ ਪੰਜਾਬੀ ਸਮਾਜ ਵਿੱਚ ਵੱਖ ਵੱਖ ਅਵਸਰਾਂ ਉੱਤੇ ਵਰਤੇ ਜਾਂਦੇ ਹਨ ਜਿਵੇਂ ਕਿ ਤਿਉਹਾਰਾਂ ਲੋਕਾਂ ਦੀ ਖੁਸ਼ੀ ਦੇ ਮੌਕੇ ਅਤੇ ਖਰੀਦਦਾਰੀ ਦੇ ਸਮੇਂ 'ਤੇ ਨਾ ਏ ਤੇ ਹੀ ਗਹਿਣੇ ਕਿਸ ਮੌਕੇ 'ਤੇ ਪਾਏ ਜਾਂਦੇ ਹਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਰਵਾਇਤੀ ਪੰਜਾਬੀ ਗਹਿਣਿਆਂ ਸਾਡੇ ਪੰਜਾਬੀ ਸਮਾਜ ਵਿੱਚ ਵੱਖ ਵੱਖ ਅਵਸਰਾਂ ਉੱਤੇ ਵਰਤੇ ਜਾਂਦੇ ਹਨ ਜਿਵੇਂ ਕਿ ਵਿਆਹ ਤਿਉਹਾਰ ਲੋਕਾਂ ਦੀ ਖੁਸ਼ੀ ਦੇ ਮੌਕੇ ਆਦਿ ਖਰੀਦਦਾਰੀ ਦੇ ਸਮੇਂ 'ਤੇ ਇਹ ਗਹਿਣੇ ਆਮ ਤੌਰ 'ਤੇ ਕੰਜੀਰੀ ਗੁਝੀਆ ਕੰਗਣ ਜੂੜੇ ਟੋਪੀ ਗਲਵੰਦ ਅੰਖੁ ਅੰਗੂਠੀਆਂ ਚੁੰਨੀ ਕੜਾ ਕੰਜ ਅਤੇ ਬਿਹਾਈ ਦੀ ਚੂੜੀ ਵਗੈਰਾ ਹੁੰਦੇ ਹਨ ਇਹਨਾਂ ਗਹਿਣਿਆਂ ਦੀਆਂ ਚੋਣਾਂ ਕਿਸੇ ਖਾਸ ਅਵਸਰ 'ਤੇ ਕੀਤੀਆਂ ਜਾਂਦੀਆਂ ਹਨ ਕਿਸੇ ਜਿਵੇਂ ਕਿ ਮੁਸੀਬਤ ਦੇ ਸਮੇਂ ਵਿੱਚ ਸ਼ਾਦੀ ਦੇ ਸਮੇਂ ਵਿੱਚ ਜਨਮਦਿਨ ਵਗੈਰਾ ਅਤੇ ਵਿਆਹ ਟਾਈਮ ਵਾਸਤੇ ਖਾਸ ਚੂੜੀਆਂ ਵੀ ਹੁੰਦੀਆਂ ਹਨ ਜੇਕਰ ਅਸੀਂ ਗਹਿਣਿਆਂ ਦੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਨਾਨੀ ਵੱਲੋਂ ਕੜਾ ਕੰਗਣ ਉਸਨੂੰ ਤੋਹਫੇ ਵਜੋਂ ਪਾਇਆ ਜਾਂਦਾ ਹੈ ਜਿਸ ਤਰ੍ਹਾਂ ਸੱਜ ਵਿਆਹੀ ਵਹੁਟੀ ਦੀ ਗੱਲ ਕਰੀਏ ਤਾਂ ਉਸਦਾ ਗਹਿਣੇ ਜਿਵੇਂ ਮਾਮੇ ਵੱਲੋਂ ਦਿੱਤਾ ਜਾਂਦਾ ਹੈ ਨੱਥ ਨੱਥ ਨਵੀਂ ਵਿਆਹੀ ਵਹੁਟੀ ਨੂੰ ਝਾਂਜਰਾਂ ਟਿੱਕਾ ਕਾਂਟੇ ਇਸ ਤਰ੍ਹਾਂ ਦੇ ਮੁਸਲਮਾਨ ਔਰਤਾਂ ਦੇ ਵੀ ਆਪੋ ਆਪਣੇ ਗਹਿਣੇ ਹੁੰਦੇ ਹਨ ਜਿਸ ਤਰ੍ਹਾਂ ਉਹ ਹੱਥ ਵਿੱਚ ਵੱਡੇ ਵੱਡੇ ਕੰਗਣ ਪਾ ਕੇ ਚਲਦੇ ਹਨ ਅਸੀਂ ਕਹਿ ਰਹੇ ਕਹੀਏ ਕਿ ਕੋਈ ਅੰਗੂਠੀਆਂ ਝਾਂਜਰਾਂ ਜਾਂ ਕੋਈ ਹੋਰ ਗਲੇ ਵਿੱਚ ਕੰਠਾ ਆਦਿ ਗਹਿਣਿਆਂ ਦਾ ਰਿਵਾਜ ਬਹੁਤ ਜ਼ਿਆਦਾ ਹੈ ਜੋ ਕਿ ਲੋਕ ਪਹਿਨਦੇ ਹਨ